ਕਾਰੋਬਾਰ ਸ਼ੁਰੂ ਕਰਦੇ ਸਮੇਂ ਪੇਂਡੂ ਲੋਕਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜੇ ਬੰਦਾ ਕਾਰੋਬਾਰ ਪਿੰਡ ਦੇ ਵਿੱਚ ਸ਼ੁਰੂ ਕਰਦਾ ਹੈ ਤਾਂ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਉਹਨੂੰ ਮਾਰਕੀਟਿੰਗ ਜਾ ਕੇ ਫਿਰ ਵੀ ਸ਼ਹਿਰ 'ਚ ਕਰਨੀ ਪੈਂਦੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾ ਜੇ ਦੇਖਿਆ ਜਾਵੇ ਜਨਸੰਖਿਆ ਜਿਹੜੀ ਹੈ ਉਹ ਰਹਿੰਦੀ ਸ਼ਹਿਰਾਂ 'ਚ ਹੈ ਸੋ ਸ਼ਹਿਰਾਂ 'ਚ ਵੱਧ ਸੇਲ ਹੋ ਸਕਦੀ ਹੈ ਸੋ ਉਹਦੇ ਕਰਕੇ ਪੇਂਡੂ ਬੰਦੇ ਨੂੰ ਫਿਰ ਜੇ ਪਿੰਡ 'ਚ ਚੀਜ਼ ਤਿਆਰ ਕਰਕੇ ਫਿਰ ਸ਼ਹਿਰ ਤੱਕ ਲੈ ਕੇ ਜਾਣੀ ਹੈ ਫਿਰ ਉਹਦਾ ਲਿਜਾਣ ਦਾ ਖਰਚਾ ਵੀ ਪੈਣਾ ਏ ਫਿਰ ਉਹਦੀ ਸਾਂਭ ਸੰਭਾਲ ਦਾ ਖਰਚਾ ਵੀ ਹੈ ਅਤੇ ਜੇ ਕੋਈ ਰਾਹ 'ਚ ਉੱਨੀ ਇੱਕੀ ਹੋ ਜਾਵੇ ਤਾਂ ਨੁਕਸਾਨ ਵੀ ਝੱਲਣਾ ਪੈ ਸਕਦਾ ਸੋ ਅਤੇ ਉਹ ਤੋਂ ਇਲਾਵਾ ਉੱਦਾਂ ਵੀ ਫਿਰ ਬਹੁਤ ਸਾਰੀਆਂ ਹੀ ਸਹੂਲਤਾਂ ਨੇ ਜਿਹੜੀਆਂ ਕਿ ਸ਼ਹਿਰਾਂ 'ਚ ਮਿਲਦੀਆਂ ਹੁਣ ਪਿੰਡਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਚੌਵੀ ਘੰਟੇ ਬਿਜਲੀ ਹੈ ਹੀ ਨਹੀਂ ਉੱਥੇ ਬਹੁਤ ਸੀਮਿਤ ਸਮਾਂ ਰਹਿੰਦੀ ਹੈ ਬਿਜਲੀ ਜਿਹਦੇ ਕਾਰਨ ਕੀ ਹੈ ਕਿ ਇੱਕ ਕਾਰੋਬਾਰੀ ਦੀ ਜੋ ਉਹਦਾ ਕੰਮ ਹੈ ਉਹਦੇ ਵਿੱਚ ਖੜਤ ਪੈ ਜਾਂਦੀ ਹੈ ਉਹ ਤੋਂ ਇਲਾਵਾ ਫਿਰ ਪਿੰਡਾਂ ਦੀਆਂ ਸੜਕਾਂ ਦੇ ਹਾਲਤ ਆ ਬਸ ਕਹਿਣਾ ਹੀ ਕਿਆ ਏ ਉਹ ਤਾਂ ਸਿਰਾ ਹੀ ਪਈਆਂ ਬਸ ਜਮ੍ਹਾਂ ਹੀ ਟੁੱਟੀਆਂ ਹੀ ਹੈ ਉਹਨਾਂ ਬ ਤਾਂ ਆਉਣ ਜਾਣ ਲੱਗੇ ਉਹੀ ਬੰਦਾ ਕਾਣ 'ਤੇ ਜਾਂਦਾ ਇਹ ਜਿਹੀਆਂ ਸੜਕਾਂ ਏ ਸੋ ਉਹਦੇ ਕਰਕੇ ਸਮਾਨ ਸਮੂਨ ਇੱਧਰ ਉੱਧਰ ਜੇ ਲੈ ਕੇ ਜਾਂਦੇ ਕੋਈ ਉਹ ਜਿਹਾ ਬੰਦੇ ਦਾ ਸਮਾਨ ਹੈ ਤਾਂ ਉਹਨੂੰ ਪੈਕਿੰਗ ਇੰਨੀ ਕੁ ਧਿਆਨ ਨਾਲ ਕਰਨੀ ਪੈਣੀ ਹੈ ਅਤੇ ਇੱਕ ਤਰੀਕੇ ਨਾਲ ਕਿ ਉਹਦਾ ਸਮਾਨ ਬਚਿਆ ਰਹੇ ਕਿਤੇ ਐਂ ਹੋਵੇ ਵੀ ਡੈਂਗਿਆਂ ਡੂੰਗਿਆਂ 'ਚ ਬ ਸਮਾਨ ਜਿਹਾ ਕੱਠਾ ਜਿਹਾ ਹੋ ਕੇ ਸਭ ਕੁਛ ਬਸ ਇੱਦਾਂ ਹੀ ਹੋ ਜਾਵੇ ਕਿਤੇ ਮਾਲ ਜਾ ਰਲਿਆ ਮਿਲਿਆ ਜਿਹਾ ਸੰਨੀ ਹੋ ਕੇ ਬੈਠੀ ਰਹੇ ਫਿਰ